ਸਾਡੇ ਇਲਾਕੇ ਦੇ ਐਮ ਐਲ ਏ ਸਾਹਿਬ ਸਰਦਾਰ ਰੁਪਿੰਦਰ ਸਿੰਘ ਜੀ ਹੈਪੀ ਹਨ ਅਤੇ ਐਮ ਪੀ ਡੋਕਟਰ ਅਮਰ ਸਿੰਘ ਹਨ ਅਤੇ ਸਾਡੇ ਪਿੰਡ ਦੇ ਸਰਪੰਚ ਸਤਵਿੰਦਰ ਸਿੰਘ ਜੀ ਹਨ ਇਹ ਸਾਡੇ ਪਿੰਡ ਦੇ ਵਿੱਚ ਐਮ ਐਲ ਏ ਵੱਲੋਂ ਅਤੇ ਐਮ ਪੀ ਵੱਲੋਂ ਵੱਖ ਵੱਖ ਕੰਮਾਂ ਲਈ ਗਰਾਂਟਾਂ ਦਿੱਤੀਆਂ ਗਈਆਂ ਅਤੇ ਸਾਡੇ ਪਿੰਡ ਨੇ ਸਰਪੰਚ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੇ ਪਿੰਡ ਦਾ ਵਿਕਾਸ ਕਰਵਾਇਆ ਹੈ ਅਤੇ ਹੁਣ ਵੀ ਸਾਡੇ ਵੇੜੇ ਵਿਹੜੇ ਦੇ ਵਿੱਚ ਆਲੇ ਦੁਆਲੇ ਵਰਮਾ 'ਤੇ ਸੜਕਾਂ 'ਤੇ ਲੋਕ ਇੱਟ ਲੱਗ ਰਹੀ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਐਮ ਐਲ ਏ ਸਾਹਿਬ ਐਮ ਪੀ ਸਾਹਿਬ ਅਤੇ ਰਿਸਪੋਂਸ ਸਰਪੰਚ ਸਾਹਿਬ ਪਿੰਡ ਦਾ ਵਿਕਾਸ ਕਰਵਾਉਂਦੇ ਨੇ ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਿੰਡ ਦਾ ਵਿਕਾਸ ਕਰ ਰਹੇ ਹਨ